ਸਾਡੇ ਖੇਤਰ ਵਿੱਚ ਮੁੱਖ ਕਿੱਤਾ ਖੇਤੀ ਹੈ ਔਰ ਰਿਵਾਇਤੀ ਖੇਤੀ ਜਿਵੇਂ ਕਿ ਕੁਦਰਤੀ ਖੇਤੀ ਬਹੁਤ ਹੀ ਚੁਣੌਤੀਆਂ ਭਰੀ ਹੈ ਇਹ ਮੌਸਮ ਇੱਥੇ ਹਰ ਤਰ੍ਹਾ ਦਾ ਮੌਸਮ ਜਿਵੇਂ ਗਰਮੀ ਸਰਦੀ ਬਰਸਾਤਾਂ ਪੱਤਝੜ ਭੰਗਾਰੇ ਦੀ ਬਾਹਰ ਵੱਖ ਵੱਖ ਕਿਸਮ ਦਾ ਮੌਸਮ ਆਉਂਦਾ ਹੈ ਔਰ ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ ਇੱਥੇ ਕੁਝ ਘੁਮਿਆਰ ਹਨ ਜੋ ਮਿੱਟੀ ਦੇ ਬਰਤਨ ਔਰ ਮੂਰਤੀਆਂ ਬਣਾਉਂਦੇ ਹਨ ਸ਼ਹਿਰ ਤੋਂ ਲੋਕ ਕੁਦਰਤੀ ਖੇਤੀ ਔਰ ਇਹ ਮਿੱਟੀ ਦੀਆਂ ਮੂਰਤੀਆਂ ਦੇਖਣ ਲਈ ਔਰ ਖਰੀਦਣ ਲਈ ਆਉਂਦੇ ਹਨ ਸਰਕਾਰ ਖੇਤੀ ਤਾਂ ਸਹੀ ਮੁੱਲ ਨਹੀਂ ਪਾ ਰਹੀ ਔਰ ਇਹ ਜੋ ਘੁਮਿਆਰ ਮੂਰਤੀਆਂ ਔਰ ਮਿੱਟੀ ਦੇ ਬਰਤਨ ਬਣਾਉਂਦੇ ਹਨ ਇਹ ਲੋਕ ਇਹਨਾਂ ਨੂੰ ਬਣਾਉਣ ਵਿੱਚ ਬਹੁਤ ਹੀ ਮੁਸ਼ਕਿਲ ਆਉਂਦੀ ਹੈ ਪਰ ਲੋਕ ਇਸ ਦਾ ਸਹੀ ਮੁੱਲ ਨਹੀਂ ਪਾਉਂਦੇ ਇਸ ਕਰਕੇ ਇਹ ਕਿੱਤੇ ਅਲੁਪਤ ਹੁੰਦੇ ਜਾ ਰਹੇ ਹਨ ਸਾਡੀ ਸਰਕਾਰ ਨੂੰ ਔਰ ਸਾਡੇ ਲੋਕਾਂ ਨੂੰ ਇਹਨਾਂ ਕਿੱਤਿਆਂ ਨੂੰ ਪ੍ਰਫੁੱਲਿਤ ਕਰਨ ਲਈ ਇਸ ਵੱਲ ਧਿਆਨ ਦੇਣ ਦੀ ਲੋੜ ਹੈ